ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਤੁਸੀਂ ਟੂਰੈਸਟ ਗਾਈਡ ਬੋਲ ਰਹੇ ਹੋ ਹਾਂਜੀ ਮੈਮ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਨਾ ਬਠਿੰਡਾ ਦੇ ਵਿੱਚ ਨਿਊ ਆਈ ਹੋਈ ਹਾਂ ਅਤੇ ਮੈਂ ਨਾ ਬਠਿੰਡਾ ਘੁੰਮਣਾ ਚਾਹੁੰਦੀ ਹਾਂ ਹਾਂ

ਹਾਂਜੀ ਮੈਮ ਤੁਸੀਂ ਦੱਸੋ ਮੈਮ ਤੁਸੀਂ ਮੈਨੂੰ ਕਿਸ ਟਾਈਮ ਘੁੰਮਾ ਸਕਦੇ ਹੋ ਠੀਕ ਹੈ ਜੀ ਮੈਮ ਤੁਹਾਡੀ ਰੈਂਟ ਫੀਸ ਕਿੰਨੀ ਹੈਗੀ ਮੈਮ

ਹਾਂਜੀ ਮੈਂ ਨਾ ਬਠਿੰਡੇ ਨਿਊ ਹੋਈ ਅਤੇ ਕਹਿ ਲਓ ਕਿ ਮੈਂ ਬਠਿੰਡਾ ਦੇ ਬਾਰੇ ਕੁਛ ਵੀ ਨਹੀਂ ਜਾਣਦੀ ਹੈਗੀ ਮੈਮ ਤਾਂ ਮੈਂ ਨਾ ਇੱਥੇ ਵੀ ਮਤਲਬ ਕਿ ਉਪਲੱਬਧ ਹੈਗੇ ਨੇ ਹਾਂਜੀ ਮੈਮ ਤਾਂ ਮੈਨੂੰ ਵੀ ਪੱਕੇ ਚਾਹੀਦੇ ਕਿਉਂਕਿ ਮੈਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਹੈ ਨਾ ਹਾਂਜੀ ਮੈਮ ਮੈਂ ਨਾ ਤੁਹਾਨੂੰ ਆਪਣਾ ਐਡਰੈਸ ਹੈਗਾ ਜਿਹੜਾ ਉਹ ਤੁਹਾਨੂੰ ਮੈਂ ਵਟਸਐਪ ਕਰ ਦਉਂਗੀ ਹਾਂਜੀ ਮੈਮ ਓਕੇ ਮੈਮ ਥੈਂਕ ਯੂ ਮੈਮ